ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਵੀਰ ਜੀ ਬੇਨਤੀ ਸੀ ਮੈਂ ਨਾ ਇੱਕ ਆਨਲਾਈਨ ਰੀਚਾਰਜ ਕੀਤਾ ਸੀ ਹਾਂਜੀ ਮੇਰਾ ਮੋਬਾਇਲ ਨੰਬਰ ਇੱਕ ਆ ਵੀਰੇ ਨੌਂ ਨੌਂ ਇੱਕ ਚਾਰ ਅੱਠ ਛੇ ਛੇ ਅੱਠ ਛੇ ਜੀਰੋ ਹਾਂਜੀ ਹਾਂਜੀ ਅਤੇ ਉਹਨਾਂ ਦਾ ਨਾ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ ਅਤੇ ਮੈਂ ਇਹ ਦੇਖਣਾ ਚਾਹੁੰਦਾ ਸੀ ਮੇਰਾ ਰੀਚਾਰਜ ਸਫ਼ਲ ਹੋ ਗਿਆ ਹੈ ਜਾਂ ਨਹੀਂ ਹੋਇਆ ਹਾਂਜੀ ਹਾਂਜੀ ਨਹੀਂ ਵੀਰੇ ਹੋ ਗਏ ਦੱਸ ਤੋਂ ਪੰਦਰਾਂ ਮਿੰਟ ਹੋ ਗਏ ਨੇ ਰੀਚਾਰਜ ਕੀਤੇ ਨੂੰ ਪਰ ਅਜੇ ਤੱਕ ਰੀਚਾਰਜ ਨਹੀਂ ਹੋਇਆ ਮੈਂ ਵੈਬਸਾਈਟ 'ਤੇ ਵੀ ਦੇਖ ਲਿਆ ਪਰ ਮੈਨੂੰ ਨਾ ਕਿਤੇ ਪਤਾ ਨਹੀਂ ਲੱਗ ਰਿਹਾ ਹੈਗਾ ਸੋ ਬੇਨਤੀ ਹੈ ਵੀ ਜੇ ਤੁਸੀਂ ਮੈਨੂੰ ਪਤਾ ਕਰਕੇ ਦੱਸ ਦਿਓ ਵੀ ਮੇਰਾ ਰੀਚਾਰਜ ਸਫ਼ਲ ਹੋਇਆ ਹੈ ਜਾਂ ਨਹੀਂ ਹੋਇਆ ਬਸ ਪੁਸ਼ਟੀ ਕਰਨੀ ਸੀਗੀ ਹਾਂਜੀ ਹਾਂਜੀ ਅਖੀਰਲੇ ਚਾਰ ਅੰਕ ਛੇ ਅੱਠ ਛੇ ਜੀਰੋ ਹਾਂਜੀ ਹਾਂਜੀ ਗੂਗਲ ਪੇ ਤੋਂ ਕੀਤਾ ਸੀ ਵੀਰੇ ਹਾਂਜੀ ਹਾਂਜੀ ਜੀਪੇ ਤੋਂ ਲਗਭਗ ਦਸ ਤੋਂ ਪੰਦਰਾਂ ਮਿੰਟ ਦਾ ਟਾਈਮ ਹੋ ਗਿਆ ਰੀਚਾਰਜ ਕੀਤੇ ਨੂੰ ਪਰ ਨਾ ਤਾਂ ਉਹਦਾ ਕੋਈ ਮੈਨੂੰ ਮੈਸੇਜ ਆਇਆ ਅਤੇ ਨਾ ਕੋਈ ਮੈਨੂੰ ਵੈਬਸਾਈਟ ਤੋਂ ਪਤਾ ਲੱਗਦਾ ਉਹਦਾ ਰੀਚਾਰਜ ਹੋਇਆ ਕਿ ਨਹੀਂ ਹਾਂਜੀ ਵੀਰ ਪੁਸ਼ਟੀ ਕਰਨੀ ਸੀਗੀ ਇਕ ਵਾਰੀ ਜੇ ਵੇਖ ਕੇ ਦੱਸ ਦਿਓ ਤਾਂ ਬੜੀ ਮਿਹਰਬਾਨੀ ਤੁਹਾਡੀ ਹਾਂ ਵੀਰੇ ਮੈਂ ਵੇਟ ਕਰ ਲੈਂਦਾ ਦੋ ਮਿੰਟ ਕੋਈ ਚੱਕਰ ਨਹੀਂ ਹਾਂ ਮੈਂ ਫਰੀ ਹਾਂ ਦੋ ਮਿੰਟ ਵੇਟ ਕਰ ਸਕਦਾ ਤੁਹਾਡੀ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਸਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਵੀਰੇ